ਭੰਗੜੇ ਦੇ ਕਈ ਸਾਰੇ ਗੀਤ ਹੁੰਦੇ ਹਨ ਉਸ ਦੇ ਵਿੱਚ ਸਭ ਤੋਂ ਮਸ਼ਹੂਰ ਗੀਤ ਜਿਵੇਂ ਕਿ ਬੱਲੇ ਬੱਲੇ ਨੱਚਦੀ ਫਿਰਾਂ ਵਿਆਹ ਵਾਲਾ ਢੋਲ ਆ ਜਾ ਮਾਹੀ ਲਾਲ ਘੱਗਰਾ ਤਰੀਫਾਂ ਪਾਣੀ ਦਾ ਰੰਗ ਲੌਂਗ ਲਾਚੀ ਇਸ ਵਿੱਚੋਂ ਮੇਰਾ ਮਨਪਸੰਦ ਹੈ ਲੌਂਗ ਲਾਚੀ ਲੌਂਗ ਲਾਚੀ ਤਾਂ ਮੇਰਾ ਐਨਾ ਹੀ ਮਨਪਸੰਦ ਹੈ ਕਿ ਇਸ ਨੂੰ ਮੈਂ ਥੋੜ੍ਹਾ ਜਿਹਾ ਗਾ ਕੇ ਵੀ ਸੁਣਾ ਸਕਦੀ ਹਾਂ ਜਿਵੇਂ ਹਾਂ ਵੇ ਤੂੰ ਲੌਂਗ ਵੇ ਮੈਂ ਲਾਚੀ ਤੇਰੇ ਪਿੱਛੇ ਆ ਗਵਾਚੀ ਹਾਂ ਵੇ ਮੈਂ ਲੌਂਗ ਵੇ ਮੈਂ ਲਾਚੀ ਤੇਰੇ ਪਿੱਛੇ ਆ ਗਵਾਚੀ ਤੇਰੇ ਇਸ਼ਕੇ ਨੇ ਮਾਰੀ ਕੁੜੀ ਕੱਚ ਦੀ ਕਵਾਰੀ ਤੇਰੇ ਇਸ਼ਕੇ ਨੇ ਮਾਰੀ ਕੁੜੀ ਕੱਚ ਦੀ ਕਵਾਰੀ ਵੇ ਮੈਂ ਚੰਬੇ ਦੇ ਪਹਾੜਾਂ ਵਾਲੀ ਸ਼ਾਮ ਵੇ ਮੁੰਡਿਆਂ ਸੰਦਲੀ ਸੰਦਲੀ ਨੈਣਾਂ ਵਿੱਚ ਤੇਰਾ ਨਾਂ ਵੇ ਮੁੰਡਿਆਂ ਸੰਦਲੀ ਸੰਦਲੀ ਨੈਣਾਂ ਵਿੱਚ ਤੇਰਾ ਨਾਂ ਵੇ ਮੁੰਡਿਆਂ